ਜਿਵੇਂ ਕਿ ਪੰਜਾਬੀ ਭਾਸ਼ਾ ਵਿੱਚ ਬਹੁਤ ਹੀ ਸਾਰੇ ਵਾਕਾਂਸ਼ ਹਨ ਅਤੇ ਮੁਹਾਵਰੇ ਹਨ ਅਤੇ ਮੁਹਾਵਰੇ ਹਨ ਜਿਨ੍ਹਾਂ ਨੂੰ ਆਮ ਲੋਕ ਬਹੁਤ ਹੀ ਆਪਣੇ ਰੋਜ਼ਾਨਾ ਗੱਲਬਾਤ ਵਿੱਚ ਵਰਤਦੇ ਹਨ ਆਪਣੀ ਗੱਲ ਨੂੰ ਦਰਸਾਉਣ ਲਈ ਜ਼ਿਆਦਾ ਗੱਲਬਾਤ ਨੂੰ ਦਰਸਾਉਣ ਲਈ ਉਹ ਘੱਟ ਆਪਣੀ ਗੱਲਬਾਤ ਨੂੰ ਥੋੜ੍ਹੇ ਲਫ਼ਜ਼ਾਂ ਵਿੱਚ ਦਰਸਾਉਣ ਲਈ ਉਹ ਮੁਹਾਵਰਿਆਂ ਦਾ ਮੁਹਾਵਰਿਆਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਛ ਮੁਹਾਵਰੇ ਹਨ ਜਿਵੇਂ ਰਾਈ ਦਾ ਪਹਾੜ ਬਣਾਉਣਾ ਰੰਗ ਲੱਗਣਾ ਰਾਮ ਰੌਲਾ ਅਤੇ ਮੋਠਾਂ ਦੀ ਛਾਵੇਂ ਬਹਿਣਾ ਠੀਕ ਹੈ ਮੂੰਹ ਮੁਲਹਾਜ਼ਾ ਹੋਣਾ ਮੱਥਾ ਡੰਮਣਾ ਮੂੰਹ ਦੀ ਖਾਣੀ ਭੰਗ ਦੇ ਭਾਅ ਜਾਣਾ ਭਸਮ ਮਲਾਉਣੀ ਭੱਠ ਝੋਕਣਾ ਭੁੰਨੇ ਤਿੱਤਰ ਉਡਾਉਣੇ ਇਹ ਕੁਛ ਇਸ ਤਰ੍ਹਾਂ ਦੇ ਮੁਹਾਵਰੇ ਹਨ ਜਿਨ੍ਹਾਂ ਨੂੰ ਆਮ ਲੋਕ ਰੋਜ਼ਾਨਾ ਆਪਣੀ ਗੱਲਬਾਤ ਵਿੱਚ ਵਰਤਦੇ ਹਨ